ਭੰਗੜਾ ਪੰਜਾਬ ਦਾ ਲੋਕ ਨਾਚ ਹੈ ਹੁਣ ਭੰਗੜਾ ਇਕੱਲਾ ਪੰਜਾਬ ਦਾ ਹੀ ਨਹੀਂ ਰਿਹਾ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਫੈਲ ਚੁੱਕਿਆ ਇਸ ਇਸ ਦੀ ਬਹੁਤ ਹੀ ਮਹੱਤਤਾ ਹੈ ਪੰਜਾਬ ਵਿੱਚ ਜਦੋਂ ਭੰਗੜਾ ਪਾਇਆ ਜਾਂਦਾ ਨਾ ਤਾਂ ਇਸ ਨਾਲ ਆਪਣੇ ਖੂਨ ਦਾ ਜਿਹੜਾ ਸੰਚਾਰ ਚੱਲਦਾ ਰਹਿੰਦਾ ਹੈ ਇਹਦੇ ਨਾਲ ਆਪਣੇ ਸਰੀਰ ਦੀ ਕਸਰਤ ਹੁੰਦੀ ਹੈ ਲ ਆਪਣੀਆਂ ਬਾਹਾਂ ਮਜ਼ਬੂਤ ਹੁੰਦੀਆਂ ਨੇ ਭੰਗੜਾ ਹਰ ਥਾਂ 'ਤੇ ਪਾਇਆ ਜਾਂਦਾ ਜਦੋਂ ਹੁਣ ਵਿਆਹ ਸ਼ਾਦੀਆਂ ਹੁੰਦੀਆਂ ਉੱਥੇ ਵੀ ਹੀ ਭੰਗੜੇ ਨੂੰ ਹੀ ਲਿਜਾਇਆ ਜਾਂਦਾ ਕਿਉਂਕਿ ਭੰਗੜਾ ਮਸ਼ੂਰ ਹੀ ਇੰਨਾਂ ਹੋ ਚੁੱਕਿਆ ਆਪਾਂ ਘਰਾਂ ਦੇ ਵਿੱਚ ਜਾਗੋ ਕੱਢਦੇ ਹਾਂ ਤਾਂ ਜਦੋਂ ਜਾਗੋ ਕੱਢਦੇ ਹਾਂ ਤਾਂ ਭੰਗੜਾ ਹੀ ਪਾਇਆ ਜਾਂਦਾ ਹੈ ਗਿੱਧਾ ਜਦੋਂ ਹੁੰਦਾ ਸਟੇਜ 'ਤੇ ਤਾਂ ਨਾਲ ਉਹਦੇ ਭੰਗੜੇ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ ਤਾਂ ਕਿ ਭੰਗੜੇ ਨਾਲ ਸਭ ਨੂੰ ਸਭ ਨੂੰ ਮਨੋਰੰਜਨ ਹੋ ਸਕੇ ਖੁਸ਼ੀ ਮਿਲ ਸਕੇ ਭੰਗੜੇ ਨਾਲ ਆਪਣੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਆਪਣੀ ਇੱਕ ਵੱਖਰੀ ਹੀ ਪਹਿਚਾਣ ਬਣਦੀ ਹੈ ਇਹਦੇ ਨਾਲ ਪੰਜਾਬੀਆਂ ਨੂੰ ਇੱਕ ਵੱਖਰਾ ਹੀ ਮੁਕਾਮ ਹਾਸਲ ਹੁੰਦਾ ਜਿੱਥੇ ਚਾਹੇ ਆਪਾਂ ਕਨੇਡਾ ਦੀ ਗੱਲ ਕਰੀਏ ਚਾਹੇ ਬਾਹਰ ਨਿਊਜ਼ੀਲੈਂਡ ਦੀ ਗੱਲ ਕਰੀਏ ਉੱਥੇ ਜਦੋਂ ਭੰਗੜਾ ਪੈਂਦਾ ਹੈ ਤਾਂ ਉੱਥੇ ਭੰਗੜਾ ਹੀ ਨਹੀਂ ਪੰਜਾਬੀਆਂ ਦੀ ਵੀ ਇੱਜ਼ਤ ਬਣਦੀ ਹੈ ਉੱਥੇ ਪੰਜਾਬੀਆਂ ਨੂੰ ਕਿਹਾ ਜਾਂਦਾ ਵੀ ਜੇ ਪੰਜਾਬੀ ਨੇ ਤਾਂ ਉੱਥੇ ਭੰਗੜਾ ਵੀ ਪੰਜਾਬੀਆਂ ਦੀ ਸ਼ਾਨ ਹੈ ਭੰਗੜੇ ਨਾਲ ਹੀ ਪੰਜਾਬ ਦੀ ਸ਼ਾਨ ਬਣਦੀ ਹੈ ਭੰਗੜਾ ਹਰ ਸਕੂਲਾਂ ਕਾਲਜਾਂ ਵਿੱਚ ਵੀ ਕਰਾਇਆ ਜਾਂਦਾ ਹੂੰ ਬੱਚਿਆਂ ਨੂੰ ਖੇਡਾਂ ਦੇ ਨਾਂ 'ਤੇ ਭੰਗੜਾ ਕਰਵਾਇਆ ਜਾਂਦਾ ਖੇਡਾਂ ਨਹੀਂ ਕਰਵਾਈਆਂ ਇੰਨੀਆਂ ਜਾਂਦੀਆਂ ਜਿੰਨਾਂ ਭੰਗੜਾ ਕਰਵਾਇਆ ਜਾਂਦਾ ਕਿਉਂਕਿ ਇਸ ਨਾਲ ਇੱਕ ਤਾਂ ਬੱਚੇ ਨੂੰ ਆਪਣੇ ਪੰਜਾਬ ਦੇ ਲੋਕ ਸੱਭਿਆਚਾਰ ਬਾਰੇ ਪਤਾ ਲੱਗਦਾ ਕਿ ਆਪਣੇ ਪੰਜਾਬ ਦਾ ਕੀ ਸੱਭਿਆਚਾਰ ਆ ਕੀ ਆਪਣੇ ਪੰਜਾਬ ਦਾ ਭੰਗੜੇ ਦਾ ਕੀ ਮਹੱਤਵ ਆ ਬੱਚੇ ਜਦੋਂ ਭੰਗੜਾ ਦੇਖਦੇ ਨੇ ਤਾਂ ਉਹ ਆਪਣੇ ਮਾਂ ਪਿਓ ਤੋਂ ਪੁੱਛਦੇ ਨੇ ਕੀ ਇਹ ਚੀਜ਼ ਹੈ ਤਾਂ ਮਾਂ ਪਿਓ ਦੱਸਦੇ ਆ ਕਿ ਬੱਚਿਓ ਜਿਹੜਾ ਭੰਗੜਾ ਨਾ ਇਹ ਆਪਣੇ ਲੋ ਆਪਣੇ ਪੰਜਾਬ ਦਾ ਲੋਕ ਨਾਚ ਹੈ ਇਹੀ ਆਪਣੇ ਇੱਕ ਦੇਸ਼ ਦੀ ਸ਼ਾਨ ਹੈ ਜੇ ਆਪਾਂ ਭੰਗੜਾ ਪੈਂਦਾ ਨਾ ਤਾਂ ਆਲੇ ਦੁਆਲੇ ਲੋਕ ਖੜ੍ਹ ਖੜ੍ਹ ਦੇਖਦੇ ਨੇ ਬਾਹਰਲੇ ਦੇਸ਼ਾਂ ਵਿੱਚ ਜਦੋਂ ਪੰਜਾਬੀ ਜਾਂਦੇ ਨੇ ਭੰਗੜਾ ਪਾਉਣ ਤਾਂ ਅੰਗਰੇਜ਼ ਦੇਖਦੇ ਨੇ ਅਤੇ ਵਾਹ ਵਾਹ ਕਰਦੇ ਨੇ